ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਤਾਂ ਇਹ ਚੀਜ਼ਾਂ ਨਹੀਂ ਹੈ ਨਾ ਕਿ ਕੁਦਰਤੀ ਪਾਰਕ ਨਦੀਆਂ ਪਹਾੜ ਵੈਟ ਲੈਂਡ ਐਹੇ ਜਿਹਾ ਕੁਛ ਨਹੀਂ ਹੈ ਪਰ ਪਟਿਆਲੇ ਵਿੱਚ ਬੀੜਾਂ ਬਹੁਤ ਹਨ ਬੀੜਾਂ 'ਚ ਕਈ ਤਰ੍ਹਾਂ ਦੇ ਜਾਨਵਰ ਪਾਏ ਜਾਂਦੇ ਹਨ ਬੀੜਾਂ ਵੀ ਮਤਲਬ ਖ਼ਾਸੇ ਨਹੀਂ ਇੱਕ ਨਹੀਂ ਖ਼ਾਸੇ ਬੀੜਾਂ ਹਨ ਉਨ੍ਹਾਂ 'ਚ ਕਈ ਤਰ੍ਹਾਂ ਦੇ ਜਾਨਵਰ ਹਨ ਜਿਵੇਂ ਬਾਂਦਰ ਹੋ ਗਿਆ ਗਊਆਂ ਹੋ ਗਈਆਂ ਮੱਝਾਂ ਆ ਗਈਆਂ ਅਤੇ ਮੋਰ ਹੋ ਗਏ ਇਸ ਤਰ੍ਹਾਂ ਖ਼ਾਸੇ ਜਾਨਵਰ ਪਾਏ ਜਾਂਦੇ ਹਨ ਅਤੇ ਦਰੱਖ਼ਤਾਂ ਦੀ ਗੱਲ ਕਰੀਏ ਨਿੰਮ ਬੋਹੜ ਪਿੱਪਲ ਕਿੱਕਰਾਂ ਬਹੁਤ ਤਰ੍ਹਾਂ ਦੇ ਪੇੜ ਦਰੱਖ਼ਤ ਪਾਏ ਜਾਂਦੇ ਹਨ ਫੁੱਲ ਹੁੰਦੇ ਹਨ ਗੁਲਾਬ ਵਗੈਰਾ ਬਹੁਤ ਫੁੱਲ ਆਦਿ ਹੁੰਦੇ ਹਨ ਪਰ ਇਸ ਤਰ੍ਹਾਂ ਦੇ ਹੋਰ ਕੋਈ ਕੁਦਰਤੀ ਚੀਜ਼ਾਂ ਨਹੀਂ ਹਨ ਜਿਵੇਂ ਕਿ ਪਹਾੜ ਆਦਿ ਇਹ ਚੀਜ਼ਾਂ ਨਹੀਂ ਹਨ ਪਾਰਕ ਨਾ ਹੀ ਕੋਈ ਪਾਰਕ ਹਨ ਆ ਬੀੜਾਂ ਆਦਿ ਹਨ